ਟੈਕਨੋਲਜੀ ਅਤੇ ਇੰਟਰਨੈਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਵਿੱਚ ਕਾਫੀ ਬਦਲਾਉ ਆ ਗਿਆ ਹੈ ਕਿਉਂਕਿ ਜੇ ਅਸੀਂ ਇੰਟਰ ਜਿਹੜੇ ਅਸੀਂ ਇੰਟਰਨੈੱਟ ਦੇ ਵਿੱਚ ਇਹ ਸਰਚ ਮਾਰ ਕੇ ਕੁਛ ਨਹੀਂ ਪਤਾ ਲੱਗਦਾ ਫਿਰ ਅਸੀਂ ਗੂਗਲ ਟਰਾਂਸਲੇਟ ਵਿੱਚ ਸਰਚ ਮਾਰ ਕੇ ਪਤਾ ਕਰ ਲੈਂਦੇ ਹਾਂ ਅਤੇ ਅਸੀਂ ਆਪਣਾ ਜਿਹੜੇ ਸਭ ਦਾ ਇੱਕ ਦੂਜੇ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਲਿਖ ਕੇ ਸੈਂਡ ਕਰ ਸਕਦੇ ਹਾਂ ਔਨਲਾਈਨ ਸਾਡਾ ਮੈਸੇਜ ਇੱਕ ਦੂਜੇ ਤੱਕ ਚਲ ਜਾਂਦਾ ਹੈ ਅਤੇ ਉਹ 'ਚ ਹਰ ਤਰ੍ਹਾਂ ਦੇ ਭਾਸ਼ਾ ਹੁੰਦੇ ਹਨ ਜਿਸ ਵਿੱਚ ਪੰਜਾਬੀ ਭਾਸ਼ਾ ਵੀ ਹੁੰਦੀ ਹੈ ਅਤੇ ਇਸਦਾ ਵਰਤੋਂ ਕਰਕੇ ਆਪਣੇ ਸੰਦੇਸ਼ ਇੱਕ ਦੂਜੇ ਤੱਕ ਭੇਜ ਸਕਦੇ ਹੈ